ਮੈਨੂੰ ਬਾਈਕਿੰਗ ਲਈ ਸਭ ਤੋਂ ਜਿਆਦਾ ਮੇਰੇ ਪਾਪਾ ਨੇ ਪ੍ਰੇਰਿਤ ਕੀਤਾ ਏ ਉਹਨਾਂ ਨੂੰ ਬਾਈਕ ਚਲਾਣ ਦਾ ਬੜਾ ਸ਼ੌਕ ਸੀ ਤੇ ਜਦੋਂ ਮੈਂ ਛੋਟਾ ਸੀ ਤੇ ਜਦੋਂ ਉਹਨਾਂ ਨੂੰ ਦੇਖਦਾ ਹੁੰਦਾ ਸੀ ਬਾਈਕ ਚਲਾਉਂਦਾ ਤੇ ਮੇਰਾ ਵੀ ਦਿਲ ਕਰਦਾ ਸੀ ਕਿ ਮੈਂ ਵੀ ਵੱਡਾ ਹੋ ਕੇ ਬਾਈਕ ਚਲਾਵਾ ਇਸ ਕਰਕੇ ਹੀ ਮੇਰੇ ਘਰ ਤੋਂ ਹੀ ਇਹ ਚੀਜ਼ ਮੇਰੇ ਨਾਲ ਚੱਲੀ ਹੈ ਅਤੇ ਹੁਣ ਮੈਂ ਬਾਈਕਿੰਗ ਲਈ ਦੂਰ ਦੂਰ ਜਾਣ ਲਈਏ ਉਹਦਾ ਹੀ ਪ੍ਰਯੋਗ ਕਰਦਾ ਹਾਂ ਜਿਵੇਂ ਕਿ ਚਿੰਤਪੁਰਨੀ ਮਾਤਾ ਤੇ ਜਾਣਾ ਹੋਵੇ ਜਾਂ ਕਿਤੇ ਹੋਰ ਵੀ ਜਾਣਾ ਹੋਵੇ ਤੇ ਮੈਂ ਬਾਈਕ ਰਾਹੀ ਜਾਂਦਾ ਹਾਂ ਅਤੇ ਪੂਰੀ ਤਿਆਰੀ ਕਰਕੇ ਹੀ ਜਾਂਦਾ ਹਾਂ ਜਿਵੇਂ ਕਿ ਮੈਡੀਕਲ ਕਿੱਟ ਹੋਰ ਵੀ ਕਈ ਚੀਜ਼ਾਂ ਵੈਦਰ ਨੂੰ ਦੇਖ ਕੇ ਹੀ ਮੈਂ ਅੱਗੇ ਜਾਂਦਾ ਹਾਂ ਅਤੇ ਇਸ ਨਾਲ ਮੈਂ ਬਹੁਤ ਜਿਆਦਾ ਖੁਸ਼ ਹੁੰਦਾ ਹਾਂ ਬਾਈਕ ਚਲਾਣਾ ਤਾਂ ਜਿਵੇਂ ਮੇਰੇ ਲਈਏ ਇੱਕ ਪ੍ਰੇਰਨਾ ਹੀ ਹ ਕਿਉਂਕਿ ਇਹ ਮੇਰੇ ਪਾਪਾ ਵੱਲੋਂ ਆਈ ਸੀ